ਸਦੀਆਂ ਵਿੱਚ ਪੰਜਾਬ ਦੀ ਆਰਥਿਕਤਾ ਵਿ ਦਾ ਵਿਕਾਸ ਬਹੁਤ ਜ਼ਿਆਦਾ ਹੋਇਆ ਇਸ ਲਈ ਇਸਦਾ ਵਿਕਾਸ ਦਾ ਮੁੱਖ ਕਾਰਨ ਖੇਤੀਬਾੜੀ ਸੀ ਸਮੇਂ ਦੇ ਸਮੇਂ ਦੇ ਨਾਲ ਜੋ ਵੀ ਤਬਦੀਲੀ ਆਈ ਖੇਤੀਬਾੜੀ ਦਾ ਉਭਾਰ ਬਹੁਤ ਹੀ ਉਗੜ ਕੇ ਸਾਹਮਣੇ ਆਇਆ ਇਸ ਵਿੱਚ ਵਿਪਾ ਖੇਤੀਬਾੜੀ ਲਈ ਬਹੁਤ ਸਾਰੇ ਫਸਲਾਂ ਉਗਾਈਆਂ ਗਈਆਂ ਇਹਨਾਂ ਫਸਲਾਂ ਦੇ ਸਦਕਾ ਬਹੁਤ ਹੀ ਆਮਦਨ ਹੋਈ ਇਸਦੇ ਨਾਲ ਨਾਲ ਫਿਰ ਸਮੇਂ ਦੇ ਨਾਲ ਨਾਲ ਉਦਯੋਗਿਕ ਕਾਰਖਾਨੇ ਵੀ ਸਥਾਪਿਤ ਕੀਤੇ ਗਏ ਇਸ ਵਿੱਚ ਖੇਤੀਬਾੜੀ ਦਾ ਉਭਾਰ ਸਭ ਤੋਂ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਇਸ ਵਿੱਚ ਵਪਾਰ ਵਪਾਰ ਦੇ ਸਾਧਨ ਵੀ ਬਹੁਤ ਜ਼ਿਆਦਾ ਸਨ ਇਸ ਇਸ ਦਾ ਮੁੱਖ ਕਾਰਨ ਇਹ ਸੀ ਕਿ ਸਮੇਂ ਦੇ ਨਾਲ ਨਾਲ ਜੋ ਸਿੱਖਿਆ ਦਾ ਪ੍ਰਸਾਰ ਹੋਇਆ ਉਸ ਵੀ ਉਸ ਵਿੱਚ ਉਦਯੋਗਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਈ ਇਸ ਵਿੱਚ ਸਮੇਂ ਦੇ ਨਾਲ ਨਾਲ ਬਹੁਤ ਸਾਰੀ ਤਬਦੀਲੀਆਂ ਆਈਆਂ